ਕੁੜੀਆਂ ਨੂੰ ਪੜ੍ਹਨ ਵਾਸਤੇ ਜ਼ਿਆਦਾਤਰ ਮੋਹਾਲੀ ਜਾਣਾ ਪੈਂਦਾ ਪਿੰਡਾਂ 'ਚ ਖਾਸ ਸਕੂਲ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਤਾਂ ਉਹਨਾਂ ਨੂੰ ਬੱਸਾਂ 'ਚ ਜਾਂ ਆਟੋ ਵਗੈਰਾ 'ਚ ਜਾਣਾ ਪੈਂਦਾ ਏ ਜੋ ਕਾਫੀ ਮੁਸ਼ਕਿਲ ਹੁੰਦਾ ਜਾਣਾ ਉਹਨਾਂ ਨੂੰ ਬਹੁਤ ਮਤਲਬ ਭੀੜ ਭੜੱਕਾ ਔਰ ਬਹੁਤ ਅਨਕੰਫਟੇਬਲ ਫੀਲ ਕਰਦੀਆਂ ਜ਼ਿਆਦਾਤਰ ਲੜਕੀਆਂ ਔਰ ਉਸ ਤੋਂ ਇਲਾਵਾ ਉਹ ਜੋਬ ਵਾਸਤੇ ਲੇਡੀਜ਼ ਬਾਹਰ ਜਾਂਦੀਆਂ ਸਵੇਰੇ ਉੱਠ ਕੇ ਉਹਨਾਂ ਨੂੰ ਜਲਦੀ ਆਪਣੇ ਘਰ ਦਾ ਕੰਮ ਕਰਕੇ ਫਿਰ ਜੋਬ 'ਤੇ ਜਾਣਾ ਪੈਂਦਾ ਫਿਰ ਆ ਕੇ ਸਾਰਾ ਪਿੱਛੇ ਤੋਂ ਸਾਂਭਣਾ ਪੈਂਦਾ ਔਰ ਜਿਸ ਤਰ੍ਹਾਂ ਕੋਲਜ ਵਿੱਚ ਉਹਨਾਂ ਨੂੰ ਪੜ੍ਹਨਾ ਔਰ ਟੀਚਰਸ ਵਗੈਰਾ ਹੁੰਦੀਆਂ ਲ ਆਪਣੇ ਨਾਲ ਮਤਲਬ ਕੋਲਜ ਟੀਚਰਸ ਪੜ੍ਹਾਉਂਦੀਆਂ ਲੇਡੀਜ਼ ਜ਼ਿਆਦਾਤਰ ਔਰ ਉਹਨਾਂ ਨੂੰ ਮਤਲਬ ਬਰਾ ਸਮਾਨਤਾ ਨਾਲ ਦੇਖਿਆ ਜਾਂਦਾ ਉਹਨਾਂ ਨੂੰ ਅੱਛੀ ਤਰ੍ਹਾਂ ਮਤਲਬ ਅੱਛਾ ਸਮਝਿਆ ਜਾਂਦਾ ਜੋ ਬਾਹਰ ਲੇਡੀਜ਼ ਜੋਬ ਕਰਦੀਆਂ ਹਨ ਔਰ ਲੇਡੀਜ਼ ਨੂੰ ਹਮੇਸ਼ਾਂ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੀਦਾ ਅੱਛੀ ਜੋਬ ਕਰਨੀ ਚਾਹੀਦੀ ਆ ਅੱਛੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ